ਭਾਅ ਜੀ ਸਤਿ ਸ਼੍ਰੀ ਅਕਾਲੀ ਜੀ ਭਾਅ ਜੀ ਮੈਂ ਇੱਕ ਮਹੀਨਾ ਪਹਿਲਾਂ ਤੁਹਾਡੇ ਤੋਂ ਮੋਬਾਇਲ ਮੰਗਵਾਇਆ ਸੀ ਜਿਹੜਾ ਕਿ ਮੈਨੂੰ ਇੱਕ ਤਾਂ ਮਿਲਿਆ ਹੀ ਬਹੁਤ ਲੇਟ ਹੈ ਜੀ ਅਤੇ ਉਸ ਤੋਂ ਬਆਦ ਜਦੋਂ ਮੈਂ ਇਹ ਅਨਬੋਕਸ ਕੀਤਾ ਤਾਂ ਇਹਦਾ ਟੱਚ ਵਗੈਰਾ ਅਤੇ ਬੈਕ ਅਤੇ ਕਾਫ਼ੀ ਸਕਰੈਚਿਸ ਸੀ ਅਤੇ ਮੈਂ ਇਸ ਨੂੰ ਦੇਖ ਕੇ ਬਹੁਤ ਤੰਗ ਹੋਇਆ ਇੰਨੇ ਪੈਸੇ ਵੀ ਲਗਾਏ ਸੀ ਮੈਂ ਇਹਦੇ 'ਤੇ ਜਦੋਂ ਇਹ ਔਨ ਹੋਇਆ ਤਾਂ ਡੇਢ ਤੋਂ ਦੋ ਘੰਟੇ ਇਹਨੇ ਔਨ ਹੋਣ ਨੂੰ ਲਾਏ ਜੀ ਅਤੇ ਉਸ ਤੋਂ ਬਾਅਦ ਜਦੋਂ ਔਨ ਹੋਇਆ ਇਹ ਟੱਚ ਨਹੀਂ ਇੱਕ ਤਾਂ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਦੂਜਾ ਨੈੱਟਵਰਕ ਇਸ਼ੂ ਹੈ ਜੀ ਇਸ ਦੇ 'ਚ ਸਪੀਕਰ ਵੀ ਕੋਈ ਖਾਸ ਇਸ ਦੇ 'ਚ ਆਵਾਜ਼ ਖਾਸ ਨਹੀਂ ਹੈ ਜੀ ਅਤੇ ਚਾਰਜਿੰਗ 'ਚ ਵੀ ਪ੍ਰੋਬਲਮ ਹੈ ਜੀ ਲੁੱਕ ਵਾਇਜ਼ ਵੀ ਇਹ ਪੁਰਾਣਾ ਲੱਗ ਲੱਗ ਰਿਹਾ ਜੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੇਰਾ ਇਹ ਮੋਬਾਇਲ ਮੋਬਾਇਲ ਵਾਲੀ ਜਿਹੜੀ ਰਾਸ਼ੀ ਹੈ ਜੀ ਰਿਫੰਡ ਕਰ ਦਿੱਤੀ ਜਾਵੇ